ਮੇਰੇ ਪਿੰਡ ਦੀ ਆਬਾਦੀ ਸੱਤ ਹਜ਼ਾਰ ਤੋਂ ਉੱਤੇ ਹੈ ਬਹੁਤ ਹੀ ਵੱਡਾ ਪਿੰਡ ਹੈ ਅਤੇ ਬਹੁਤ ਹੀ ਸੋਹਣਾ ਬਣਿਆ ਹੈ ਮੇਰੇ ਪਿੰਡ ਦੇ ਵਿੱਚ ਹਰੇਕ ਤਰ੍ਹਾਂ ਦੀ ਸੁੱਖ ਸਹੂਲਤ ਹੈ ਉਸ ਦੇ ਨਾਲ ਨਾਲ ਮੈਂ ਇੱਕ ਖੇਤੀਬਾੜੀ ਦੇ ਨਾਲ ਨਾਲ ਆਪਣੇ ਆਪ ਨੂੰ ਇੱਕ ਡੇਅਰੀ ਫਾਰਮ ਦੇ ਕਿੱਤੇ ਨਾਲ ਜੋੜਿਆ ਹੈ ਜੋ ਕਿ ਮੇਰੇ ਕੋਲੇ ਪੰਦਰ੍ਹਾਂ ਮੱਝਾਂ ਹਨ ਦੋ ਮੇਰੇ ਕੋਲ ਨੌਕਰ ਰੱਖੇ ਹਨ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਸੁਚੱਜੇ ਢੰਗ ਨਾਲ ਆਪਣੇ ਡੇਅਰੀ ਫਾਰਮ ਨੂੰ ਚਲਾ ਰਿਹਾ ਹਾਂ ਮੇਰੇ ਕੋਲ ਰਟਾ ਰੋਜ਼ਾਨਾ ਦੀ ਰੁਟੀਨ ਵਿੱਚ ਘਰਾਂ ਵਾਲੇ ਆ ਕੇ ਦੁੱਧ ਲੈ ਕੇ ਜਾਂਦੇ ਹਨ ਅਤੇ ਮੈਨੂੰ ਨਗਦ ਦੀ ਨਗਦ ਪੇਮੈਂਟ ਕਰਕੇ ਜਾਂਦੇ ਹਨ ਮੇਰਾ ਜਿਹੜਾ ਡੇਲੀ ਦਾ ਰੁਟੀਨ ਹੈ ਮੇਰਾ ਸ਼ੌਕ ਦੇ ਤੌਰ 'ਤੇ ਮੈਂ ਆਪਣੇ ਪਸ਼ੂ ਪਾਲਣ ਦੇ ਕਿੱਤੇ ਨੂੰ ਕਰਦਾ ਹਾਂ ਅਤੇ ਬਹੁਤ ਹੀ ਵਧੀਆ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਪਹਿਲਾਂ ਕੁਛ ਪਹਿਲਾਂ ਮੇਰੇ ਕੋਲ ਪੰਦਰ੍ਹਾਂ ਮੱਝਾਂ ਸੀ ਹੌਲੀ ਹੌਲੀ ਫਿਰ ਮੈਂ ਵੀਹ ਕਰ ਲਈਆਂ ਪੱਚੀ ਕਰ ਲਈਆਂ ਇੱਕ ਜਿਹੜਾ ਪਸ਼ੂ ਪਾਲਣ ਦਾ ਕਿੱਤਾ ਜੋ ਕਿ ਆਪਾਂ ਨੂੰ ਇੱਕ ਬਹੁਤ ਹੀ ਵਧੀਆ ਉੱਚੀਆਂ ਅਤੇ ਬੁਲੰਦੀਆਂ ਨੂੰ ਛੂਹ ਸਕਦਾ ਹੈ ਕਿਉਂਕਿ ਦੁੱਧ ਦੀ ਜਿਹੜੀ ਮਾਤਰਾ ਹਰੇਕ ਆਮ ਇੱਕ ਚੰਗੇ ਅਤੇ ਮਾੜੇ ਇੱਕ ਛੋਟੇ ਅਤੇ ਵੱਡੇ ਵਰਗ ਦੇ ਆਦਮੀ ਨੂੰ ਦੁੱਧ ਦੀ ਲੋੜ ਪੈਂਦੀ ਹੀ ਪੈਂਦੀ ਹੈ ਜੇ ਮੈਂ ਮੰਨਾਂ ਇਹ ਹੋ ਗਿਆ ਪਸ਼ੂਆਂ ਦਾ ਕਿੱਤਾ ਜੋ ਕਿ ਬੰਦਿਆਂ ਦੇ ਕਰਨ ਦੇ ਹੱਕ ਵਿੱਚ ਆਉਂਦਾ ਹੈ ਇਸ ਤਰ੍ਹਾਂ ਜੇ ਆਪਾਂ ਇੱਕ ਲੇਡੀ ਦੇ ਮੰਨੀਏ ਜੋ ਕਿ ਘਰ ਬੈਠ ਕੇ ਇੱਕ ਬੁਟੀਕ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੀ ਹੈ ਜੋ ਕਿ ਘਰ ਬੈਠ ਕੇ ਆਪਣੇ ਆਪ ਤੁਹਾਡੇ ਕੋਲ ਗਾਹਕ ਆਊਗਾ ਅਤੇ ਉਸ ਨੇ ਤੁਹਾਨੂੰ ਕੱਪੜੇ ਦੇ ਕੇ ਜਾਣੇ ਅਤੇ ਤੁਸੀਂ ਸਿਲਾਈ ਕਰਕੇ ਆਪਣੇ ਘਰ ਦਾ ਗੁਜ਼ਾਰਾ ਬਹੁਤ ਹੀ ਚੰਗੇ ਤਰੀਕੇ ਨਾਲ ਚਲਾ ਸਕਦੇ ਹੋ